ਹੈਲੋ ਹਾਂਜੀ ਬਾਬਾ ਜੀ ਸਤਿ ਸ਼੍ਰੀ ਅਕਾਲ ਅੱਛਾ ਮੈਨੂੰ ਨਾ ਮੈਂ ਹੈਗਾ ਇੱਥੋਂ ਟੂਰਿਸਟ ਆਇਆਂ ਤੁਹਾਡੇ ਪੰਜਾਬ ਦੇ ਵਿੱਚ ਬਾਹਰੋਂ ਅਤੇ ਮੈਨੂੰ ਥੋੜ੍ਹਾ ਜਿਹਾ ਇੱਥੇ ਬੜੇ ਗੁਰਦੁਆਰਾ ਸਾਹਿਬ ਹੈਗੇ ਇੱਥੇ ਮੈਂ ਦੇਖਿਆ ਮੈਨੂੰ ਥੋੜ੍ਹਾ ਜਿਹਾ ਇਹਨਾਂ ਬਾਰੇ ਦੱਸ ਦਉਗੇ ਦੋ ਚਾਰ ਮਿੰਟ ਜੇ ਹੈਗਾ ਟਾਈਮ ਤਾਂ ਤੁਹਾਡੇ ਕੋਲ ਕੁਛ ਕਿਸੇ ਕਿਸੇ ਦੱਸ ਦਓ ਇੱਥੇ ਜਿਵੇਂ ਮੈਂ ਇੱਥੇ ਦੇਖਿਆ ਸੀ ਗੁਰਦੁਆਰਾ ਫਤਿਹਗੜ੍ਹ ਸਾਹਿਬ ਹੈਗਾ ਹੈ ਬੜਾ ਵੱਡਾ ਗੁਰਦੁਆਰਾ ਹੈਗਾ ਹੈ ਤੋ ਉਹਨਾਂ ਉਹਨਾਂ ਬਾਰੇ ਹਾਂਜੀ ਹਾਂ ਹਾਂਜੀ

ਅੱਛਾ ਜੀ ਠੀਕ ਹੈ ਜੀ

ਠੀਕ ਹੈ ਜੀ ਹਾਂਜੀ ਅੱਛਾ ਜੀ

ਠੀਕ ਹੈ ਠੀਕ ਹੈ

ਨਹੀਂ ਬਾਬਾ ਜੀ ਇੱਕ ਗੱਲ ਇੱਕ ਗੱਲ ਮੈਨੂੰ ਦਿਮਾਗ 'ਚ ਆ ਰਹੀ ਆ ਵੀ ਦੱਸੋ ਵੀ ਜਿਵੇਂ ਕਿ ਉਹਨਾਂ ਨੂੰ ਜਿਉਂਦਿਆਂ ਨੂੰ ਦੀਵਾਰ ਦੇ ਵਿੱਚ ਚਿਣਵਾ ਦਿੱਤਾ ਸੀਗਾ

ਅਤੇ ਉਹ ਇਹ ਕਿੰਨੇ ਕੁ ਸਾਲ ਪੁਰਾਣੀ ਗੱਲ ਹੈ ਅੱਛਾ ਤਾਂ ਫਿਰ ਉਸ ਟਾਈਮ ਕੋਈ ਰੋਕਣ ਵਾਲਾ ਹੈ ਨਹੀਂ ਸੀ ਉਹਨਾਂ ਨੂੰ ਵੀ ਜਾਂ ਸਲਾਹ ਦੇਣ ਵਾਲਾ ਹੈ ਨਹੀਂ ਸੀ ਵੀ ਇੱਦਾਂ ਨਹੀਂ ਕਰਨਾ ਚਾਹੀਦਾ ਵੀ ਬੱਚੇ ਤਾਂ ਬੱਚੇ ਹੀ ਨੇ

ਠੀਕ ਹੈ ਜੀ

ਅੱਛਾ ਫਿਰ ਹੁਣ ਓ ਤਾਂ ਓ ਉਹ ਹਾਂਜੀ

ਅੱਛਾ ਜੀ

ਵੀ ਮੋਹਰਾ ਮਤਲਬ ਵੀ ਕੋਈ ਸੋਨੇ ਦੇ ਸਿੱਕੇ

ਅੱਛਾ ਵੀ ਉਹਨਾਂ ਨੇ ਇਹ ਕਹਿ ਲਓ ਵੀ ਉਹ ਜਗ੍ਹਾ ਸੰਸਕਾਰ ਲਈ ਵੀ ਵੇਚੀ ਅਤੇ ਉਹ ਵੀ ਜਗ੍ਹਾ ਨਹੀਂ ਦਿੱਤੀ ਸੰਸਕਾਰ ਲਈ ਬੜਾ ਬੜੇ ਤਸੀਹੇ ਦਿੰਦੇ ਸੀ ਹਾਂਜੀ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ